ਹੈਲੋ ਹਾਂਜੀ ਮੈਮ ਕਲੱਬ ਕੋਡੀਨੇਟਰ ਬੋਲ ਰਹੇ ਹੋ ਜੀ ਹਾਂਜੀ ਮੈਮ ਤੁਹਾਨੂੰ ਜਿਵੇਂ ਕਿ ਪਤਾ ਹੈ ਕਿ ਬੱਚਿਆਂ ਨੇ ਛੁੱਟੀਆਂ ਨੇ ਅੱਜ ਕੱਲ੍ਹ ਹੈ ਨਾ ਸਮਰ ਵਕੇਸ਼ਨ ਚੱਲ ਰਹੀਆਂ ਨੇ ਬੱਚਿਆਂ ਦੀਆਂ ਤਾਂ ਬੱਚੇ ਮਤਲਬ ਸਕੂਲ ਦਾ ਕੰਮ ਤਾਂ ਕਰ ਹੀ ਲੈਂਦੇ ਹੈਗੇ ਹੈ ਠੀਕ ਹੈ ਡੇਲੀ ਵਰਕ ਬੇਸਿਸ 'ਤੇ ਆਉਂਦਾ ਹੈਗਾ ਉਹ ਸਕੂਲ ਕੰਮ ਕਰ ਲੈਂਦੇ ਹੈਗੇ ਹੈ ਤਾਂ ਉਹ ਬਾਅਦ 'ਚ ਫ੍ਰੀ ਹੁੰਦੇ ਆ ਬੱਚੇ ਠੀਕ ਹੈ ਤਾਂ ਮੈਂ ਸੋਚ ਰਹੀ ਸੀਗੀ ਕਿ ਬੱਚਿਆਂ ਨੂੰ ਕਲੱਬ ਜੁਆਇਨ ਕਰਵਾ ਦੇਵਾਂ ਠੀਕ ਹੈ ਮ ਬੱਚੇ ਨੂੰ ਮਤਲਬ ਡਾਂਸ 'ਚ ਜ਼ਿਆਦਾ ਇੰਟਰਸਟ ਹੈਗਾ ਅਤੇ ਤੁਸੀਂ ਇੱਥੇ ਮੈਮ ਬੱਚਾ ਜੀ ਤੇਰਾਂ ਸਾਲ ਦਾ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਮੈਮ ਬੱਚਿਆਂ ਨੂੰ ਐਕਚੁਅਲ 'ਚ ਹਾਂਜੀ ਡਾਂਸ 'ਚ ਇੰਟਰਸਟ ਹੈ ਮੈਮ ਮੋਰਨਿੰਗ ਬੈਚ ਹੀ ਸਹੀ ਰਹੇਗਾ ਵੈਸੇ ਤੁਹਾਨੂੰ ਹਾਂਜੀ ਹਾਂਜੀ ਮੈਮ ਅਤੇ ਮੈਮ ਚਾਰਜਸ ਕੀ ਲਉਂਗੇ ਜੀ ਹਾਂਜੀ ਹਾਂਜੀ ਪਰ ਮੰਥ ਹੈ ਮੈਮ ਜਾਂ ਫਿਰ ਓਕੇ ਮੈਮ

ਹਾਂਜੀ ਹਾਂਜੀ ਹਾਂਜੀ ਓਕੇ ਮੈਮ ਕੈਸ਼ ਹੀ ਲਉਂਗੇ ਜਾਂ ਫਿਰ ਔਨਲਾਈਨ ਵਗੈਰਾ ਕੋਈ ਹਾਂਜੀ ਮੈਮ ਹਾਂਜੀ ਮੈਮ ਕੋਈ ਹਾਂਜੀ ਅ ਡੈਮੋ ਕਲਾਸਿਜ ਵਗੈਰਾ ਲੱਗਦੀਆਂ ਨੇ ਹਾਂਜੀ ਹਾਂਜੀ ਓਕੇ ਮੈਮ ਹਾਂਜੀ ਮੈਮ ਫਿਰ ਮੈਂ ਇੱਦਾਂ ਕਰਦੀ ਹਾਂ ਕਿ ਤੁਹਾਨੂੰ ਮਤਲਬ ਜ ਸਾਰਾ ਬਾਇਓਡਾਟਾ ਸੈਂਡ ਕਰ ਦਿੰਦੀ ਹਾਂ ਬੱਚੇ ਦਾ ਅਤੇ ਉਹ ਦੋ ਦਿਨ ਦੀ ਆਪਣੀ ਡੈਮੋ ਕਲਾਸਿਸ ਲਗਾ ਲੇਗਾ ਅਤੇ ਫਿਰ ਉਸ ਤੋਂ ਬਾਅਦ ਅਗਰ ਉਹਨੂੰ ਮਤਲਬ ਸਹੀ ਲੱਗਿਆ ਤਾਂ ਉਹ ਕੰਟੀਨਿਊ ਕਰ ਲੇਗਾ ਜੀ ਫਿਰ ਹਾਂਜੀ ਓਕੇ ਮੈਮ ਥੈਂਕ ਯੂ ਜੀ ਓਕੇ